ਇਹ ਏਰੀਏ ਦੇ ਵਿੱਚ ਅਲੱਗ ਅਲੱਗ ਕਿਸਮ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ ਜਿਹਨਾਂ ਵਿਚ ਮੁੱਖ ਕਰਕੇ ਝੋਨਾ ਆਲੂ ਮੱਕੀ ਕਣਕ ਆਦਿ ਅਤੇ ਪਸ਼ੂਆਂ ਦੀ ਖੇਤੀ ਦੇ ਵਿੱਚ ਬੱਕਰੀ ਮੱਝ ਗਾਵਾਂ ਆਦਿ